ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਤੁਹਾਡੇ ਤੋਂ ਕੈਬ ਬੁੱਕ ਕਰਵਾਈ ਸੀ ਡਰਾਇਵਰ ਤਾਂ ਟਾਇਮ ਨਾਲ ਹੀ ਆ ਗਿਆ ਸੀ ਪਰ ਜਦੋਂ ਮੈਂ ਬੈਠਣ ਲੱਗਾ ਕਿ ਸੀਟਾਂ ਦੀ ਬੁਰੀ ਹਾਲਤ ਸੀ ਇੱਕ ਤਾਂ ਸੀਟਾਂ ਪਾਟੀਆਂ ਸਨ ਅਤੇ ਉੱਪਰ ਇੰਨਾਂ ਖਲਾਰਾ ਅਤੇ ਇੰਨੀਆਂ ਗੰਦੀਆਂ ਸਨ ਕਿ ਮੇਰਾ ਬੈਠਣਾ ਤਾਂ ਕੀ ਵੇਖਣ ਨੂੰ ਦਿਲ ਨਹੀਂ ਕਰਦਾ ਸੀ ਇੰਨੀ ਮਾੜੀ ਸਰਵਿਸ ਇੰਨੀ ਬੁਰੀ ਹਾਲਤ ਕਿ ਮੈਨੂੰ ਬੜੀ ਬੇਇਜ਼ਤੀ ਮਹਿਸੂਸ ਹੋਈ ਕਿ ਮੇਰੇ ਨਾਲ ਮੇਰੇ ਰਿਸ਼ਤੇਦਾਰ ਵੀ ਸਨ ਮੈਂ ਉਹਨਾਂ ਨੂੰ ਘੁੰਮਾਉਣ ਲਈ ਲੈ ਕੇ ਜਾਣਾ ਸੀ ਪਰ ਉਹਨਾਂ ਦਾ ਵੀ ਮੂਡ ਅੋਫ ਹੋ ਗਿਆ ਦੂਜਾ ਡਰਾਇਵਰ ਨੂੰ ਜੁਕਾਮ ਸੀ ਪਰ ਉਸਨੇ ਕੋਈ ਵੀ ਮਾਸਕ ਨਹੀਂ ਪਾਇਆ ਸੀ ਤੁਹਾਨੂੰ ਪਤਾ ਹੈ ਕਿ ਕੋਵਿਡ ਤੋਂ ਬਾਅਦ ਸਾਰਿਆਂ ਲਈ ਮਾਸਕ ਪਾਉਣਾ ਜ਼ਰੂਰੀ ਹੋ ਹੈ ਤਾਂ ਕਿ ਇੰਨਫੈਕਸ਼ਨ ਨਾ ਹੋ ਸਕੇ ਸੋ ਮੈਂ ਤੁਹਾਡੀ ਕੰਪਨੀ ਨੂੰ ਸ਼ਿਕਾਇਤ ਕਰਦਾ ਹਾਂ ਕਿ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ